ਜੇਕਰ ਮੈਂ ਆਪਣੇ ਪਰਸਨਲ ਸੰਦਰਭ ਦੇ ਵਿੱਚ ਆਪਣੇ ਵਿਅਕਤੀਗਤ ਸੰਦਰਭ ਦੇ ਵਿੱਚ ਮੈਂ ਦੱਸਾਂ ਤਾਂ ਜੇਕਰ ਮੈਨੂੰ ਕਿਸੇ ਵੱਖਰੇ ਦੇਸ਼ ਦੀ ਯਾਤਰਾ ਕਰਨ ਦਾ ਜੇ ਮੌਕਾ ਮਿਲਦਾ ਹੈ ਤਾਂ ਮੈਂ ਜਿਹੜਾ ਇਜਰਾਇਲ ਦੇਸ਼ ਦੇ ਵਿੱਚ ਜਾਣਾ ਪਸੰਦ ਕਰਾਂਗਾ ਇਸ ਦੇ ਪਿੱਛੇ ਇੱਕ ਕਾਰਨ ਹੈ ਕਾਰਨ ਇਹ ਹੈ ਕਿ ਮੈਂ ਉੱਥੋਂ ਦੀ ਮਹਾਨ ਧਰਤੀ ਦੇ ਵਿੱਚ ਜਾ ਕੇ ਉੱਥੇ ਦੇਖਣਾ ਚਾਹੁੰਦਾ ਹਾਂ ਕਿ ਜੋ ਕ੍ਰਿਸਚਨ ਜਿਹੜੀ ਸਮਾਜ ਨੇ ਜਿਹੜੇ ਕ੍ਰਿਸਚਨ ਜਿਹੜੇ ਪ੍ਰਭੂ ਯਿਸ਼ੂ ਮਸੀਹ ਨੂੰ ਮੰਨਦੇ ਨੇ ਜਾਂ ਉਹਨਾਂ ਦਾ ਜਿਹੜਾ ਜੀਵਨ ਆ ਉੱਥੇ ਕਿਵੇਂ ਬਤੀਤ ਹੋਇਆ ਮੈਂ ਉੱਥੇ ਯਰੂਸ਼ਲਮ ਦੇ ਵਿੱਚ ਜਾ ਕੇ ਘੁੰਮਣਾ ਪਸੰਦ ਕਰਾਂਗਾ ਉੱਥੇ ਮੈਂ ਦਰਸ਼ਨ ਕਰਨਾ ਪਸੰਦ ਕਰਾਂਗਾ ਉਹਨਾਂ ਥਾਵਾਂ ਦਾ ਜਿੱਥੇ ਜਿੱਥੇ ਪ੍ਰਭੂ ਯਿਸ਼ੂ ਮਸੀਹ ਨੇ ਜਿਹੜੇ ਚਰਨ ਆਪਣੇ ਪਾਏ ਔਰ ਮੈਂ ਉਹਨਾਂ ਦੀ ਕਬਰ ਨੂੰ ਖੁੱਲ੍ਹਿਆ ਹੋਇਆ ਦੇਖਣਾ ਚਾਹੁੰਦਾ ਹਾਂ ਆਪਣੇ ਇਹਨਾਂ ਚਾਹੁੰਦੀਆਂ ਅੱਖੀਆਂ ਦੇ ਵਿੱਚ ਮੈਂ ਉਸਨੂੰ ਘੁੰਮਣਾ ਪਸੰਦ ਕਰਾਂਗਾ ਅਤੇ ਉੱਥੋਂ ਦੀਆਂ ਫੋਟੋਆਂ ਖਿੱਚ ਕੇ ਆਪਣੇ ਇੱਕ ਐਲਬਮ ਦੇ ਵਿੱਚ ਰੱਖਾਂ ਅਤੇ ਜਿਸ ਦੇ ਵਿੱਚ ਮੈਂ ਉੱਥੋਂ ਦੀਆਂ ਯਾਦਾਂ ਨੂੰ ਬਟੋਰ ਸਕਾਂ ਅਤੇ ਸਿੱਖਿਆ ਦਾਇਕ ਚੀਜ਼ਾਂ ਨੂੰ ਉਭਾਰ ਕੇ ਸਾਹਮਣੇ ਲਿਆ ਸਕਾਂ ਤਾਂ ਜਿਹੜੀ ਗੱਲ ਹੈ ਦੇਸ਼ ਘੁੰਮਣ ਦੀ ਤਾਂ ਸਭ ਤੋਂ ਵੱਡੀ ਗੱਲ ਇਹੀ ਹੈ ਵੀ ਜੇਕਰ ਘੁੰਮਣ ਦਾ ਸ਼ੌਕ ਹੈ ਤਾਂ ਇਸ ਲਈ ਨਾ ਘੁੰਮੋ ਵੀ ਅਸੀਂ ਜਸਟ ਇੰਜੋਏ ਕਰਨਾ ਹੈ ਤਾਂ ਅਜਿਹੀ ਥਾਵਾਂ ਦੇ ਉੱਤੇ ਘੁੰਮੋ ਜਿੱਥੋਂ ਸਾਨੂੰ ਸਿੱਖਿਆ ਦਾਇਕ ਸਾਡੇ ਜੀਵਨ ਨੂੰ ਸ਼ਾਂਤਮਈ ਪੂਰੀ ਜਿਹੜੀ ਟੈਨਸ਼ਨਾਂ ਭਰੀ ਜ਼ਿੰਦਗੀ ਦੇ ਵਿੱਚੋਂ ਵੱਖ ਕਰਕੇ ਇੱਕ ਆਨੰਦ ਭਰੇ ਮੌਸਮ ਦੇ ਵਿੱਚ ਜੀਵਨ ਦੇ ਵਿੱਚ ਲੈ ਜਾਵੇ ਅਜਿਹੀਆਂ ਥਾਵਾਂ ਦੇ ਉੱਤੇ ਸਾਨੂੰ ਟਰੈਵਲਿੰਗ ਕਰਨੀ ਚਾਹੀਏ ਘੁੰਮਣਾ ਚਾਹੀਦਾ ਹੈ ਤਾਂ ਜਿੰਨਾ ਮੇਰਾ ਪਰਸਨਲ ਵਿਅਕਤੀਗਤ ਸੰਦਰਭ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇ ਮੈਂ ਚਾਹਾਂ ਮੈਨੂੰ ਵੀ ਮੌਕਾ ਮਿਲਦਾ ਹੈ ਤਾਂ ਮੈਂ ਇਜਰਾਇਲ ਦੇਸ਼ ਦੇ ਵਿੱਚ ਜਾਣਾ ਪਸੰਦ ਕਰਾਂਗਾ